ਬਿਜਲੀ ਕਲੈਕਸ਼ਨ ਨਵਾਂ ਲੈਣ ਲਈ ਮੈਂ ਆਪਣੇ ਮਨੇਜਰ ਨਾਲ ਮੀਟਿੰਗ ਤੈਅ ਕੀਤੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਜਾ ਕੇ ਮੈਨੂੰ ਨਵਾਂ ਬਿਜਲੀ ਕਨੈਕਸ਼ਨ ਦਵਾਓ ਉਹਨਾਂ ਨੇ ਮੇਰੇ ਨਾਲ ਜਾ ਕੇ ਸਾਰੇ ਡਾਕੂਮੈਂਟ ਲੈ ਕੇ ਜ਼ਮੀਨ ਦੀ ਤਸਦੀਕ ਵਗੈਰਾ ਸਾਰਾ ਕੁਝ ਲੈ ਕੇ ਮੇਰੇ ਨਾਲ ਗਏ

ਤੁਹਾਨੂੰ ਨਵਾਂ ਕਨੈਕਸ਼ਨ ਦਵਾਵਾਂਗਾ ਇਸ ਤਰ੍ਹਾਂ ਅਸੀਂ ਸਾਰੀ ਗੱਲਬਾਲ ਗੱਲਬਾਤ ਕਰਕੇ ਬਿਜਲੀ ਘਰ ਤੋਂ ਨਵਾਂ ਕਨੈਕਸ਼ਨ ਲੈਣ ਲਈ ਅਰਜ਼ੀ ਦੇਣ ਲਈ ਜ਼ਰੂਰੀ ਦਸਤਾਵੇਜ਼ ਲੈ ਕੇ ਜਾਣ ਲਈ ਤਿਆਰ ਹੋ ਗਏ